ਯੋਗ ਨੇ ਮੇਰੇ ਸਰੀਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਯੋਗਦਾਨ ਪਾਇਆ ਹੈ ਜਦ ਤੋਂ ਮੈਂ ਯੋਗਾ ਕਰਨਾ ਸਟਾਰਟ ਕੀਤਾ ਹੈ ਤਦ ਤੋਂ ਮੈਂ ਤੰਦਰੁਸਤ ਹਾਂ ਮੈਨੂੰ ਕਿਸੇ ਤਰ੍ਹਾਂ ਦੀ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਕੋਈ ਕਦੀ ਵੀ ਬੁਖਾਰ ਖਾਂਸੀ ਜੁਕਾਮ ਇਨਫੈਕਸ਼ਨ ਆਦਿ ਕੋਈ ਵੀ ਬਿਮਾਰੀ ਮੈਨੂੰ ਅੱਜ ਤੱਕ ਨਹੀਂ ਹੋਈ ਜਦ ਤੋਂ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਹੈ ਯੋਗਾ ਯੋਗ ਨੇ ਮੇਰੇ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਤਬਦੀਲੀ ਲਿਆਂਦੀ ਹੈ ਯੋਗ ਕਰਨ ਨਾਲ ਮੈਂ ਆਪਣੇ ਸਰੀਰ ਨੂੰ ਤੰਦਰੁਸਤ ਮਹਿਸੂਸ ਕੀਤਾ ਹੈ ਕੋਈ ਤਨਾਵ ਨਹੀ ਕੋਈ ਟੈਨਸ਼ਨ ਨਹੀਂ ਇਕਦਮ ਤੰਦਰੁਸਤ ਮਹਿਸੂਸ ਕੀਤਾ ਹੈ ਯੋਗ ਮੇਰੇ ਲਈ ਯੋਗ ਮੇਰੇ ਲਈ ਬਹੁਤ ਹੀ ਜ਼ਰੂਰੀ ਬਣ ਗਿਆ ਹੈ ਯੋਗਾ ਕਰਨ ਲਈ ਮੈਨੂੰ ਬਹੁਤ ਹੀ ਜ਼ਿਆਦਾ ਤੋਂ ਜ਼ਿਆਦਾ ਤੰਦਰੁਸਤੀ ਮਿਲਦੀ ਹੈ ਯੋਗਾ ਕਰਨ ਲਈ ਮੈਂ ਬਹੁਤ ਹੀ ਅਵਲ ਹਾਂ ਮੈਨੂੰ ਯੋਗਾ ਕਰਨਾ ਬਹੁਤ ਹੀ ਪਸੰਦ ਆ ਯੋਗੇ ਨਾਲ ਮੈਨੂੰ ਮੇਰੇ ਸ਼ਰੀਰ ਵਿੱਚ ਬੜੀ ਜ਼ਿਆਦਾ ਤਬਦੀਲੀ ਵੇਖਣ ਨੂੰ ਮਿਲੀ ਹੈ ਨਾ ਕਿਸੇ ਤਰ੍ਹਾਂ ਦਾ ਬੀਪੀ ਵੱਧਣਾ ਨਾ ਕਿਸੇ ਤਰ੍ਹਾਂ ਦਾ ਸਟਰੈਸ ਨਾ ਹੀ ਮੇਰੇ ਬੋਡੀ ਵਿੱਚ ਕਿਸੇ ਤਰ੍ਹਾਂ ਦਾ ਫੈਟ ਆ ਮੈਂ ਇਕਦਮ ਫਿਟ ਹਾਂ ਠੀਕ ਹਾਂ ਤੰਦਰੁਸਤ ਹਾਂ ਜਦ ਤੋਂ ਮੈਂ ਯੋਗ ਕਰਨਾ ਸਟਾਰਟ ਕੀਤਾ ਹੈ ਯੋਗ ਨੇ ਮੇਰਾ ਜੀਵਨ ਹੀ ਬਦਲ ਦਿੱਤਾ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਯੋਗ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਹੈ ਯੋਗ ਸਾਡੇ ਲਈ ਬਹੁਤ ਹੀ ਜ਼ਰੂਰੀ ਬਣ ਗਿਆ ਹੈ